ਭੰਗੜਾ ਐਰੋਬਿਕਸ ਫਿਟਨਸ ਦੀ ਦੁਨੀਆ ਦੇ ਵਿੱਚ ਸ਼ਮੂਲੀਅਤ ਅਤੇ ਵਿਭਿੰਨਤਾ ਨੂੰ ਉਤਸ਼ਾਹਿਤ ਕਰਦਾ ਹੈ ਕਿਉਂਕਿ ਪੁਰਾਣੇ ਸਮੇਂ ਤੋਂ ਹੀ ਕਸਰਤ ਦਾ ਇੱਕੋ ਇੱਕ ਤਰੀਕਾ ਮੰਨਿਆ ਜਾਂਦਾ ਹੈ ਕਿ ਤੁਸੀਂ ਸਵੇਰੇ ਉੱਠੋ ਯੋਗਾ ਕਰੋ ਜਾਂ ਗਰਾਊਂਡ ਵਿੱਚ ਜਾਓ ਉੱਥੇ ਕਸਰਤ ਕਰੋ ਦੌੜੋ ਭੱਜੋ ਜੰਪ ਲਗਾਓ ਜਾਂ ਇਸ ਤੋਂ ਬਿਨਾ ਰੱਸੀ ਟੱਪਣਾ ਇਸ ਤਰ੍ਹਾਂ ਦੀਆਂ ਕਸਰਤਾਂ ਕਰਨ ਨਾਲ ਸਾਡੇ ਸਰੀਰ ਨੂੰ ਫਾਇਦਾ ਮਿਲਦਾ ਹੈ ਪਰ ਇਸ ਵਿੱਚ ਸੰਗੀਤ ਜਦ ਜੁੜ ਜਾਂਦਾ ਹੈ ਤਾਂ ਅਸੀਂ ਇੱਕ ਸੰਗੀਤ ਦੀ ਹੈਲਪ ਦੇ ਨਾਲ ਇਹਦੀ ਸਹਾਇਤਾ ਦੇ ਨਾਲ ਇਹ ਕਮਰੇ ਵਿੱਚ ਬੈਠ ਕੇ ਹੀ ਆਪਣੀ ਕਸਰਤ ਵੀ ਕਰ ਸਕਦੇ ਹਾਂ ਅਤੇ ਆਪਣਾ ਮਨੋਰੰਜਨ ਵੀ ਕਰ ਸਕਦੇ ਹਾਂ ਭੰਗੜਾ ਐਰੋਬਿਕਸ ਨੇ ਕਸਰਤ ਕਰਨ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਇਸ ਨਾਲ ਬਹੁਤ ਸਾਰੇ ਲੋਕ ਇਹਦੇ ਨਾਲ ਜੁੜ ਰਹੇ ਹਨ ਕਿਉਂਕਿ ਉਹਨਾਂ ਦਾ ਮੰਨੋਰੰਜਨ ਵੀ ਹੁੰਦਾ ਹੈ ਨਾਲ ਨਾਲ ਉਹਨਾਂ ਦੇ ਸਰੀਰ ਦੀ ਫਿਟਨੈਸ ਵੀ ਚੰਗੀ ਰਹਿੰਦੀ ਹੈ ਭੰਗੜਾ ਐਰੋਬਿਕਸ ਬੱਚਿਆਂ ਵਿੱਚ ਬੜਾ ਮਸ਼ਹੂਰ ਹੋ ਰਿਹਾ ਹੈ ਅੱਜ ਕੱਲ੍ਹ ਦੀ ਤਣਾਅ ਭਰੀ ਜ਼ਿੰਦਗੀ ਦੇ ਵਿੱਚ ਸਾਨੂੰ ਮਿਊਜਿਕ ਦੀ ਲੋੜ ਹੈ ਸੰਗੀਤ ਦੀ ਲੋੜ ਹੈ ਅਤੇ ਨਾਲ ਹੀ ਕਸਰਤ ਦੀ ਵੀ ਲੋੜ ਹੈ ਤਾਂ ਭੰਗੜਾ ਐਰੋਬਿਕਸ ਦੋਵਾਂ ਚੀਜ਼ਾਂ ਦਾ ਇੱਕ ਚੰਗਾ ਸੁਮੇਲ ਹੈ ਜਿਸ ਨਾਲ ਬੱਚਿਆਂ ਦੇ ਬਜ਼ੁਰਗਾਂ ਦੇ ਅਤੇ ਨੌਕਰੀ ਕਰਨ ਵਾਲੇ ਜਿਹਨਾਂ ਕੋਲ ਸਮਾਂ ਘੱਟ ਹੈ ਸਾਰਿਆਂ ਦੀਆਂ ਹੀ ਇੱਛਾਵਾਂ ਪੂਰੀਆਂ ਹੋ ਰਹੀਆਂ ਹਨ ਇਸ ਤਰ੍ਹਾਂ ਜਿਹੜਾ ਭੰਗੜਾ ਐਰੋਬਿਕਸ ਹੈ ਉਹ ਸਾਨੂੰ ਕਸਰਤ ਕਰਨ ਲਈ ਬੜਾ ਉਤਸ਼ਾਹਿਤ ਕਰਦਾ ਹੈ ਸਾਡਾ ਮਨ ਹਮੇਸ਼ਾ ਰਹਿੰਦਾ ਹੈ ਕਿ ਕਦੋਂ ਉਹ ਸਮਾਂ ਆਵੇ ਜਦੋਂ ਅਸੀਂ ਕਸਰਤ ਕਰ ਸਕੀਏ ਸਾਰਿਆਂ ਨੂੰ ਭੰਗੜਾ ਐਰੋਬਿਕਸ ਦਾ ਜੋ ਪ੍ਰੋਗਰਾਮ ਹੈ ਇਸ ਵਿੱਚ ਹਿੱਸਾ ਲੈਣਾ ਚਾਹੀਦਾ ਹੈ